ਮੈਨੂੰ ਲੱਗਦਾ ਹਰੇਕ ਮਨੁੱਖ ਦੇ ਜ਼ਿੰਦਗੀ ਵਿੱਚ ਕੋਈ ਨਾ ਕੋਈ ਅਜਿਹਾ ਬੰਦਾ ਹੋਵੇਗਾ ਜਿਹਦੇ ਨਾਲ਼ ਰਹਿ ਕੇ ਜਾਂ ਜਿਹਦੇ ਨਾਲ਼ ਟਾਈਮ ਸਪੈਂਡ ਕਰਕੇ ਉਹਨੂੰ ਬਹੁਤ ਖੁਸ਼ੀ ਮਿਲਦੀ ਹੋਵੇਗੀ ਮੇਰੀ ਵੀ ਜ਼ਿੰਦਗੀ ਵਿੱਚ ਅਜਿਹੇ ਕਈ ਲੋਕ ਨੇ ਜਿਹਨਾਂ ਨਾਲ਼ ਰਹਿ ਕੇ ਅਤੇ ਜਿਨ੍ਹਾਂ ਨਾਲ਼ ਸਮੇਂ ਬਤੀਤ ਕਰਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਪੇਰੈਂਟਸ ਆਉਂਦੇ ਨੇ ਮੈਨੂੰ ਮੇਰੇ ਮਾਪਿਆਂ ਨਾਲ਼ ਰਹਿ ਕੇ ਅਤੇ ਉਹਨਾਂ ਦੇ ਚਿਹਰੇ ਦੇ ਵਿੱਚ ਹੱਸੀ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਅਤੇ ਦੂਜੀ ਤਰਫ਼ ਕਹਿੰਦੇ ਜਿਹਦੇ ਯਾਰ ਚੰਗੇ ਹੋਣ ਨਾ ਉਹ ਬੰਦਾ ਬਹੁਤ ਲੱਕੀ ਹੁੰਦਾ ਅਤੇ ਮੈਂ ਉਹਨਾਂ ਵਿੱਚੋਂ ਇੱਕ ਹਾਂ ਬੀਕੋਜ ਅੱਜ ਦੇ ਟਾਈਮ ਦੇ ਵਿੱਚ ਅੱਜ ਦਾ ਬਨਾਵਟੀ ਦੁਨੀਆਂ ਦੇ ਵਿੱਚ ਮੈਨੂੰ ਅਜਿਹੇ ਦੋਸਤ ਮਿਲੇ ਜਿਹੜੇ ਬਹੁਤ ਜ਼ਿਆਦਾ ਮੇਰਾ ਕਰਦੇ ਨੇ ਮੇਰੇ ਨਾਲ਼ ਰਹਿੰਦੇ ਨੇ ਮੇਰੀ ਪਰਵਾਹ ਕਰਦੇ ਨੇ ਉਹਨਾਂ ਨਾਲ਼ ਰਹਿ ਕੇ ਉਹਨਾਂ ਨਾਲ਼ ਸਮੇਂ ਬਤੀਤ ਕਰਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਅਤੇ ਮੇਰੇ ਚਿਹਰੇ 'ਤੇ ਇੱਕ ਵੱਖ ਖੁਸ਼ੀ ਹੁੰਦੀ ਹੈ ਮੈਂ ਖਾਣਾ ਬਣਾਉਣ ਦੀ ਬਹੁਤ ਸ਼ੌਕੀਨ ਹਾਂ ਅਤੇ ਜਦ ਵੀ ਮੈਂ ਕੁਛ ਬਣਾਉਂਦੀ ਹਾਂ ਅਤੇ ਕਿਸੇ ਨੂੰ ਖੁਆਉਣੀ ਹਾਂ ਅਤੇ ਜਦੋਂ ਉਹ ਬੰਦਾ ਮੇਰੀ ਤਾਰੀਫ਼ ਕਰੇ ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਕਿ ਮੈਂ ਕਿਸੇ ਨੂੰ ਖਵਾਇਆ ਪਿਆਇਆ ਅਤੇ ਮੇਰਾ ਬਣਾਈ ਹੋਈ ਚੀਜ਼ ਉਹਨਾਂ ਨੂੰ ਸਾਹਮਣੇ ਵਾਲੇ ਨੂੰ ਪਸੰਦ ਆਈ ਉਦੋਂ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਮੇਰਾ ਭਾਣਜਾ ਅਤੇ ਮੇਰਾ ਭਤੀਜੇ ਨੇ ਜਿਵੇਂ ਜਿਹੜੇ ਕਿ ਦੋ ਅਤੇ ਚਾਰ ਸਾਲ ਦੇ ਨੇ ਅਤੇ ਜਦੋਂ ਵੀ ਮੈਂ ਉਹਨਾਂ ਨਾਲ਼ ਹੁੰਦੀ ਹਾਂ ਉਹਨਾਂ ਦੇ ਚਿਹਰੇ 'ਤੇ ਹੱਸੀ ਵੇਖਦੀ ਹਾਂ ਉਦੋਂ ਵੀ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਅਤੇ ਕਿਸੇ ਦੀ ਮਦਦ ਕਰਕੇ ਕਿਸੇ ਦਾ ਚੰਗਾ ਕਰਕੇ ਰੱਬ ਅੱਗੇ ਜਦੋਂ ਵੇਖਦੇ ਹਾਂ ਉਦੋਂ ਬਹੁਤ ਚੰਗਾ ਲੱਗਦਾ ਏ ਕਿ ਆਪਾਂ ਕੁਛ ਵਧੀਆ ਖੱਟਿਆ ਅਤੇ ਉਦੋਂ ਵੀ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਕਿ ਮੇਰੇ ਕਰਕੇ ਕਿਸੇ ਦੇ ਚਿਹਰੇ 'ਤੇ ਹੱਸੀ ਆਈ